ਹੈਲੋ ਸਤਿ ਸ੍ਰੀ ਅਕਾਲ ਜੀ ਤੁਸੀਂ ਮਿਊਂਸੀਪਲ ਦਫਤਰ ਬਰਨਾਲਾ ਤੋਂ ਗੱਲ ਕਰਦੇ ਹੋ ਅੱਛਾ ਅੱਛਾ ਹਾਂਜੀ ਸਰ ਮੇਰਾ ਨਾ ਕਚਹਿਰੀ ਕੋਟ ਦੇ ਆਪਣਾ ਜਿਹੜਾ ਸੜਕ ਦੇ ਉੱਪਰ ਨਾ ਮੈਂ ਮਕਾਨ ਬਣਾਉਣ ਦੀ ਪਲੈਨਿੰਗ ਕਰ ਰਿਹਾ ਹੈਗਾ ਅਤੇ ਜਿਹੜਾ ਮੇਰਾ ਪੁਰਾਣਾ ਮਕਾਨ ਹੈ ਨਾ ਕਾਫੀ ਉਹ ਪਹਿਲਾਂ ਆਲਾ ਮਕਾਨ ਨਾ ਕਾਫੀ ਪੁਰਾਣਾ ਹੋ ਗਿਆ ਅਤੇ ਹੁਣ ਮੈਨੂੰ ਇਹ ਹੈ ਕਿ ਇਸ ਮਕਾਨ ਨੂੰ ਨਾ ਢਾਹ ਕੇ ਨਾ ਅਸੀਂ ਨਵਾਂ ਮਕਾਨ ਬਣਾਉਣਾ ਹੈਗਾ ਪਰ ਹੁਣ ਦੇਖੋ ਸ਼ਹਿਰ ਦਾ ਕੰਮ ਹੈਗਾ ਨਾ ਵੀ ਢਬਾ ਢਵਾ ਵੀ ਅਤੇ ਕੂੜਾ ਕਰਕਟ ਹੈ ਨਾ ਕਿੰਨਾ ਕੁਝ ਨਿਕਲੂਗਾ ਉਥੋਂ ਅਤੇ ਉਹਦਾ ਵੀ ਨਿਪਟਾਰਾ ਵੀ ਇਹ ਮੈਂ ਸਮੇ ਸਿਰ 'ਤੇ ਕਰੀ ਜਾਵਾਂ ਤਾਂ ਚੰਗੀ ਗੱਲ ਹੈ ਕਿਉਂਕਿ ਜੇ ਮੈਂ ਢੇਰ ਹੀ ਉੱਥੇ ਏਡੇ ਏਡੇ ਲਾ ਕੇ ਰੱਖ ਲਏ ਤਾਂ ਉਹਦੇ ਨਾਲ ਤਾਂ ਲੋਕਾਂ ਨੂੰ ਜਿਹੜੀਆਂ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਊਗਾ ਹੈ ਨਾ ਅਤੇ ਉਹ ਆਵਾਜਾਈ ਕਿੰਨੀ ਦੇ ਵਿੱਚ ਵਿਘਨ ਪਊਗਾ ਠੀਕ ਹੈ ਨਾ ਫਿਰ ਮੈਂ ਤਾਂ ਵੀ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਗਾ ਜਿਹੜਾ ਇਹ ਮਲਬਾ ਨਿਕਲੂਗਾ ਵੀ ਤੁਸੀਂ ਨਾ ਮੇਰੀ ਮਦਦ ਜ਼ਰੂਰ ਕਰਿਓ ਠੀਕ ਹੈ ਵੀ ਤੁਸੀਂ ਮੈਨੂੰ ਅਗਰ ਟਰੈਕਟਰ ਵਗੈਰਾ ਹੈ ਨਾ ਅਤੇ ਵੀ ਸਮੇਂ ਸਮੇਂ 'ਤੇ ਦੇਖੋ ਮੈਂ ਇਹ ਵੀ ਆਪਦੀ ਲੇਬਰ ਨਾਲ ਲਾਉਂਗਾ ਅਤੇ ਜੇ ਆਪਾਂ ਰਲ ਮਿਲ ਕੇ ਮੇਰੇ ਉਸ ਮਲਬੇ ਦਾ ਆਪਾਂ ਕੋਈ ਨਿਵਾਰਨ ਕਰ ਸਕੀਏ ਉਹਨੂੰ ਆਪਾਂ ਦੂਰ ਕਰ ਸਕੀਏ ਨਾ ਤਾਂ ਜਿਹੜਾ ਕਿਸੇ ਕੋਲ ਤੁਹਾਡੇ ਸੈ ਆਪਣੇ ਸ਼ਹਿਰ ਦੇ ਵਿੱਚ ਵੀ ਆਪਣੇ ਸ਼ਹਿਰ ਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਊਗੀ ਅਤੇ ਹੁਣ ਵੀ ਜੇ ਕੂੜੇ ਕਰਕਟ ਦਾ ਢੇਰ ਹੀ ਮੈਂ ਉੱਥੇ ਲਾਈ ਰੱਖਿਆ ਅਤੇ ਨਾ ਉਹਦੇ ਵਿੱਚ ਕੀ ਹੈਗਾ ਆਪਣਾ ਜਿਹੜਾ ਮੱਛਰ ਵਗੈਰਾ ਪੈਦਾ ਹੋਊ ਮੱਖੀਆਂ ਹੈ ਨਾ ਅਤੇ ਉਹਦੇ ਨਾਲ ਕੋਈ ਬਿਮਾਰੀਆਂ ਫੈਲਣਗੀਆਂ ਬਿਮਾਰੀਆਂ ਵੀ ਫੈਲਦੀਆਂ ਨਾਲੇ ਜਦੋਂ ਰਾਹ 'ਚ ਏਡੇ ਏਡੇ ਢੇਰ ਲੱਗ ਗਏ ਮੇਰੇ ਉਹ ਲੋਕਾਂ ਨੂੰ ਲੰਘਣ ਆਉਣ ਜਾਣ ਨੂੰ ਵੀ ਬਹੁਤ ਔਖਾ ਹੋਊਗਾ ਅਤੇ ਬਸ ਇਹੀ ਹੈਗਾ ਵੀ ਮੈਂ ਨਾ ਤੁਹਾਨੂੰ ਬਾਰ ਬਾਰ ਦੇਖੋ ਬਾਹਲਾ ਵੱਡਾ ਢੇਰ ਸਰ ਮੈਂ ਲਾਉਂਦਾ ਨਹੀਂ ਗਾ ਅਤੇ ਜਿਵੇਂ ਵੀ ਛੋਟੀ ਜੀ ਢੇਰ ਢੇਰੀ ਹੋਇਆ ਕੋਈ ਇੱਕ ਟਰਾਲੀ ਵਾਲੀ ਹੈ ਨਾ ਪਲੀਜ਼ ਕਿਰਪਾ ਕਰਕੇ ਨਾ ਤੁਸੀਂ ਮੈਨੂੰ ਆਪ ਦਾ ਜਿਹੜਾ ਮਿਊਸੀਪਲ ਕਮੇਟੀ ਦਾ ਤੁਹਾਡਾ ਟਰੈਕਟਰ ਟਰਾਲੀ ਉਹ ਦੇ ਦਿਆ ਕਰਿਓ ਅਤੇ ਹਾਂ ਲੇਬਰ ਆਪਦੀ ਲਗਾ ਕੇ ਮੈਂ ਭਰ ਦਿਆ ਕਰੂੰਗਾ ਅਤੇ ਹਾਂ ਹਾਂਜੀ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਉਹ ਉਹ ਕਹਿ ਦਿੰਦਾ ਹੈਗਾ ਤੁਹਾਡੇ ਨਾਲ ਵਾਅਦਾ ਕਰਦਾ ਵੀ ਜਿਹੜਾ ਉਹਦਾ ਪੈਟਰੋਲ ਦਾ ਖਰਚਾ ਹੋਉਗਾ ਨਾ ਡੀਜ਼ਲ ਦਾ ਟਰੈਕਟਰ ਦੇ ਵਿੱਚ ਉਹ ਵੀ ਮੈਂ ਤੁਹਾਨੂੰ ਦੇਵਾਂਗਾ ਬਸ ਨਾ ਤੁਸੀਂ ਮੇਰੀ ਇੰਨੀ ਕੁ ਮਦਦ ਜ਼ਰੂਰ ਕਰਿਓ ਹਾਂਜੀ ਹਾਂਜੀ ਹਾਂ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਦੇਖੋ ਸਾਹਿਬ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਹੀਂ ਹੋਊ ਮੈਨੂੰ ਇਹ ਐ ਵੀ ਮੇਰੇ ਕਰਕੇ ਹੈ ਨਾ ਹੋਰ ਸ਼ਹਿਰ ਵਾਸੀਆਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਜਿਹੜਾ ਮੇਰਾ ਇਹ ਮਲਬਾ ਹੈਗਾ ਅਤੇ ਉਹ ਸਮੇਂ ਸਮੇਂ 'ਤੇ ਆਪਾਂ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਚੱਕੀ ਜਾਇਆ ਕਰਾਂਗੇ ਹਾਂਜੀ ਸਰ ਜੋ ਵੀ ਫੀਸ ਹੋਊਗੀ ਇਹਦਾ ਕੋਈ ਉਹ ਹੋਊਗਾ ਉਹ ਵੀ ਮੈਂ ਸਾਰਾ ਦਫਤਰ ਨੂੰ ਤੁਹਾਨੂੰ ਪੇ ਕਰੂੰਗਾ ਬਸ ਮੇਰੀ ਇੰਨੀ ਕੁ ਮਦਦ ਕਰ ਦਿਓ ਹੈ ਨਾ ਤੁਸੀਂ ਹਾਂਜੀ ਸਰ ਓਕੇ ਸਰ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਜੀ